ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਤੁਸੀਂ ਭੰਗੜਾ ਕਲੱਬ ਹਾਊਸ ਤੋਂ ਬੋਲ ਰਹੇ ਹੋ ਹਾਂਜੀ ਹਾਂਜੀ ਸਰ ਮੈਂ ਨਾ ਐਡਮਿਸ਼ਨ ਕਰਵਾਉਣੀ ਸੀ ਆਪਣੇ ਬੱਚੇ ਦੀ ਇੱਥੇ

ਬੱਚਾ ਫਿਫਥ ਕਲਾਸ 'ਚ ਅਜੇ ਬਾਰ੍ਹਾਂ ਸਾਲ ਦਾ ਹਾਂਜੀ ਹੋਰ ਨਹੀਂ ਤੁਸੀਂ ਈਵਨਿੰਗ ਦੀ ਦੱਸ ਦਿਓ ਬਿਕੋਜ਼ ਉਹਨੇ ਸਕੂਲ ਵਗੈਰਾ ਜਾਣਾ ਹੁੰਦਾ ਫਿਰ ਆ ਕੇ ਥੋੜ੍ਹੀ ਦੇਰ ਰੈਸਟ ਕਰਕੇ ਅਤੇ ਫਿਰ ਮੈਂ ਉਹਨੂੰ ਭੇਜ ਦਾਂਗੀ ਕਿਉਂਕਿ ਉਹ ਨਾ ਥੋੜ੍ਹਾ ਬਹੁਤ ਖਾ ਖਾ ਕੇ ਮੋਟਾ ਹੁੰਦਾ ਜਾ ਰਿਹਾ ਬੈਠ ਬੈਠ ਕੇ ਸਾਰਾ ਦਿਨ ਟੀ ਵੀ ਦੇਖਦਾ ਰਹਿੰਦਾ ਕਿਸੇ ਐਕਟੀਵਿਟੀ 'ਚ ਇਨਵੋਲਵ ਨਹੀਂ ਹੁੰਦਾ ਫਿਰ ਇਸ ਕਰਕੇ ਮੈਂ ਸੋਚਿਆ ਕਿ ਉਹਨੂੰ ਕਿਸੇ ਹਾਂਜੀ ਹਾਂਜੀ ਨਾਲੇ ਥੋੜ੍ਹਾ ਉਹਨੂੰ ਹ ਕਲਚਰਲ ਐਕਟੀਵਿਟੀ 'ਚ ਜਾਏਗਾ ਅਤੇ ਥੋੜ੍ਹਾ ਹੋਏਗਾ ਥੋੜ੍ਹਾ ਮਾਈਂਡ ਵੀ ਉਹਦਾ ਫਰੈਸ਼ ਹੋਏਗਾ

ਓਕੇ ਠੀਕ ਹੈ ਠੀਕ ਹੈ ਸਰ ਹਾਂਜੀ ਬਿਲ ਹਾਂਜੀ ਹਾਂਜੀ ਇੱਟ ਵਿਲ ਬੀ ਵੈਰੀ ਮੋ ਕੰਫਰਟੇਬਲ ਠੀਕ ਹੈ ਓਕੇ ਸਰ ਥੈਂਕ ਯੂ ਡਨ ਮੈਂ ਕੱਲ੍ਹ ਫਿਰ ਛੱਡ ਜਾਂਦੀ ਹਾਂ ਇਹਨੂੰ ਠੀਕ ਹੈ ਠੀਕ ਥੈਂਕ ਯੂ